ਇਹ ਸਭ ਤੋਂ ਅਣਕਿਆਸੀ ਜਿਹੜੀ ਹੈ ਔਫ ਦਾ ਬੀਟ ਪਾਥ ਉਹ ਇਸ ਤਰ੍ਹਾਂ ਵੀ ਇੱਕ ਵਾਰੀ ਮੈਂ ਚਲਾ ਗਿਆ ਘੁੰਮਣ ਫਿਰਨ ਸੱਜਣਾਂ ਮਿੱਤਰਾਂ ਨਾਲ ਤਾਂ ਸਿੱਧੇ ਪਹਾੜੀ ਮਤਲਬ ਇਲਾਕੇ ਦੇ ਵਿੱਚ ਉੱਪਰ ਚਲਾ ਗਿਆ ਉੱਪਰ ਜਾ ਕੇ ਫਿਰ ਸ਼ੋਰਟਕੱਟ ਥੋੜ੍ਹੇ ਮਤਲਬ ਬਹੁਤ ਜ਼ਿਆਦਾ ਉੱਥੇ ਬਾਗ਼ ਵੀ ਸੀਗਾ ਪਹਾੜਾਂ ਦੇ ਉੱਤੇ ਹੋਰ ਜਾਨਵਰ ਵੀ ਸੀਗੇ ਦੇਖਣ ਦਾ ਕਿਆ ਨਜ਼ਾਰਾ ਆਇਆ ਉੱਥੇ ਫੁੱਲ ਬੂਟੇ ਵੀ ਸੀਗੇ ਅੱਛੇ ਸੀਗੇ ਉਹ ਬਹੁਤ ਚੀਜ਼ ਅੱਛੀ ਲੱਗੀ ਕਿਉਂਕਿ ਉੱਥੇ ਕਈ ਅਦਭੁੱਤ ਕੁਦਰਤੀ ਨਜ਼ਾਰਾ ਬਣ ਗਿਆ ਕੁਦਰਤੀ ਨਜ਼ਾਰਾ ਉਹਦੇ 'ਤੇ ਮਤਲਬ ਸੱਜੇ ਖੱਬੇ ਕੁਦਰਤੀ ਜਿਹੜੇ ਘਾਹ ਵੀ ਸੀਗਾ ਫੁੱਲ ਬੂਟੇ ਦਰੱਖ਼ਤ ਪਕਸ਼ੀ ਰੰਗ ਬਿਰੰਗੇ ਪਕਸ਼ੀ ਨੇੜੇ ਉਹਦੇ ਝੀ ਝੀਲ ਵੀ ਸੀਗੀ ਝੀਲ ਦੇ ਵਿੱਚ ਅਦਭੁੱਤ ਜਾਨਵਰ ਜਿਹੜੇ ਸੱਜਿਓਂ ਖੱਬਿਓਂ ਆ ਕੇ ਬਹਿੰਦੇ ਸੀਗੇ ਬਹੁਤ ਰੰਗ ਬਿਰੰਗਾ ਨਜ਼ਾਰਾ ਸੀ ਕਿਆ ਬਾਤ ਹੈ ਓਕੇ